ਜਿਹੜਾ ਵਿਅਕਤੀ ਨਵਾਂ ਨਵਾਂ ਚਿੱਤਰਕਾਰੀ ਦਾ ਦੌਰ ਸ਼ੁਰੂ ਕੀਤਾ ਹੈ ਉਸ ਨੂੰ ਆਪਣੇ ਖੇਤਰ ਦੇ ਵਿੱਚ ਨਿਪੁੰਨ ਬਣਨ ਦੇ ਲਈ ਥੋੜ੍ਹੀ ਮਿਹਨਤ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ੁਰੂਆਤੀ ਪੱਧਰ ਤੋਂ ਸ਼ੁਰੂ ਹੋ ਕੇ ਹੌਲ਼ੀ ਹੌਲ਼ੀ ਅੱਗੇ ਆਪਣੇ ਹੁਨਰ ਨੂੰ ਵਧਾਵੇ ਅਤੇ ਇਸ ਕਿੱਤੇ ਦੇ ਵਿੱਚ ਜਾ ਕੇ ਹੁਨਰ ਨੂੰ ਮਹਿਸੂਸ ਕਰੇ ਔਰ ਉਹਨੂੰ ਸੁਧਾਰੇ